ਹਾਈਕਿੰਗ ਕਰਨ ਲਈ ਮੇਰੀ ਮਨ ਪਸੰਦ ਜਗ੍ਹਾ ਪਹਾੜ ਹੈ ਕਿਉਂਕਿ ਪਹਾੜਾਂ 'ਤੇ ਜਾਣਾ ਮੈਨੂੰ ਬਹੁਤ ਹੀ ਵਧੀਆ ਲੱਗਦਾ ਹੈ ਅਤੇ ਅਸੀਂ ਹਾਈਕਿੰਗ ਕਰਨ ਲਈ ਮਕਲੋੜਗੰਜ ਮਕਲੋੜਗੰਜ ਗਏ ਸੀਗੇ ਉੱਥੋਂ ਦੇ ਪਹਾੜ ਦੇਖੇ ਅਤੇ ਸਾਡਾ ਟਰੈਕਿੰਗ ਕਰਨ ਦਾ ਵੀ ਮਨ ਬਣ ਗਿਆ ਜਦ ਅਸੀਂ ਟਰੈਕਿੰਗ ਕਰਨ ਗਏ ਤਾਂ ਅਸੀਂ ਪਹਿਲਾਂ ਸਾਰਾ ਦਿਨ ਪਹਾੜਾਂ 'ਤੇ ਚੜ੍ਹਦੇ ਰਹੇ ਅਤੇ ਜਦ ਰਾਤ ਨੂੰ ਟੈਂਟ ਲਗਾ ਕੇ ਉੱਥੇ ਹੀ ਆਰਾਮ ਕੀਤਾ ਅਸੀਂ ਆਪਣੇ ਨਾਲ ਕੁਝ ਖਾਣ ਪੀਣ ਦਾ ਸਮਾਨ ਛੋਟਾ ਸਿਲੰਡਰ ਅਤੇ ਹੋਰ ਚੀਜ਼ਾਂ ਵੀ ਨਾਲ ਲੈ ਕੇ ਹੀ ਗਏ ਸੀਗੇ ਜਦ ਅਸੀਂ ਸਵੇਰੇ ਉੱਠ ਕੇ ਬਾਹਰ ਦੇਖਿਆ ਤਾਂ ਉਹ ਬਹੁਤ ਹੀ ਵਧੀਆ ਨਜ਼ਾਰਾ ਸੀਗਾ ਉੱਚੇ ਵੱਡੇ ਵੱਡੇ ਬਰਫੀਲੇ ਪਹਾੜ ਸੀਗੇ ਅਤੇ ਨਾਲ ਦੀ ਨਾਲ ਉੱਥੋਂ ਇੱਕ ਦਰਿਆ ਵੀ ਵਗਦਾ ਸੀਗਾ ਅਤੇ ਉਸ ਅਸੀਂ ਉਹ ਵਿਊ ਨੂੰ ਬਹੁਤ ਇੰਜੋਏ ਕੀਤਾ ਉੱਥੇ ਬਹੁਤ ਹੀ ਵਧੀਆ ਵਧੀਆ ਫੋਟੋਆਂ ਖਿੱਚੀਆਂ ਅਤੇ ਵੀਡੀਓ ਬਣਾਈਆਂ ਅਤੇ ਫਿਰ ਅਸੀਂ ਉੱਥੇ ਸੂਰਜ ਡੁੱਬਣ ਦਾ ਨਜ਼ਾਰਾ ਵੀ ਬਹੁਤ ਵਧੀਆ ਦੇਖਿਆ ਅਤੇ ਸ਼ਾਮ ਨੂੰ ਅਸੀਂ ਵਾਪਸ ਆਪਣੀ ਜਗ੍ਹਾ 'ਤੇ ਆ ਚੁੱਕੇ ਸੀਗੇ ਸਾਡਾ ਦਿਨ ਬਹੁਤ ਹੀ ਵਧੀਆ ਲੰਘਿਆ ਉੱਥੇ